ਇਕ ਜਨਵਰੀ ਦੋ ਹਜ਼ਾਰ ਪੰਜ ਤੇਰਾਂ ਅਗਸਤ ਦੋ ਹਜ਼ਾਰ ਪੰਜ ਇਕ ਅਪ੍ਰੈਲ ਉੱਨੀ ਸੌ ਸਤਾਹਠ ਤੇਈ ਦਸੰਬਰ ਦੋ ਹਜ਼ਾਰ ਸੌਲਾਂ ਤੀਹ ਮਈ ਦੋ ਹਜ਼ਾਰ ਅੱਠ